ਪੰਜਾਬ ਦੇ ਵਿੱਚ ਜਿਹੜੀ ਘਟਨਾ ਦੀ ਗੱਲ ਕਰੀਏ ਤਾਂ ਜਿਹੜੀ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਬਹੁਤ ਪੁਰਾਣੀ ਅਤੇ ਬਹੁਤ ਮਹੱਤਵਪੂਰਨ ਹੈਗੀ ਆ ਇਹ ਘਟਨਾ ਨੂੰ ਲੋਕ ਅੱਜ ਵੀ ਮਨਾਉਂਦੇ ਨੇ ਉਹਨਾਂ ਸ਼ਹੀਦਾਂ ਨੂੰ ਯਾਦ ਰੱਖਣ ਲਈ ਯਾਦਗਾਰੀ ਇੱਕ ਦੇ ਲਈ ਸ਼ਰਧਾਂਜਲੀ ਦੇਣ ਲਈ ਹਰ ਸਾਲ ਇਹ ਮਨਾਇਆ ਜਾਂਦਾ ਹੈ ਕਿਉਂਕਿ ਇਹ ਬਹੁਤ ਵੱਡੀ ਇਤਿਹਾਸਿਕ ਘਟਨਾ ਹੈਗੀ ਆ ਅਤੇ ਇੱਕ ਆਜ਼ਾਦੀ ਦੀ ਘਟਨਾਵਾਂ ਉਹਦੇ ਵਿੱਚੋਂ ਇਕ ਸਭ ਤੋਂ ਵੱਡੀ ਮਹੱਤਵਪੂਰਨ ਘਟਨਾ ਹੈ